ਮੈਨੂੰ ਬਚਪਨ ਤੋਂ ਹੀ ਪੇਂਟਿੰਗ ਦਾ ਬੜਾ ਸ਼ੌਂਕ ਹੈ ਹਰੇਕ ਅਲੱਗ ਅਲੱਗ ਤਰ੍ਹਾਂ ਦੀ ਪੇਂਟ ਕਰਨਾ ਮੈਂ ਵਧੀਆ ਲੱਗਦੀ ਹੈ ਅਲੱਗ ਅਲੱਗ ਤਰ੍ਹਾਂ ਦੀ ਪਰ ਅੱਜ ਹੁਣ ਹਰੇਕ ਤਰ੍ਹਾਂ ਦੀ ਸਮ ਪੇਂਟ ਤਾਂ ਕਿੰਨੇ ਤਰ੍ਹਾਂ ਦੇ ਆਉਂਦੇ ਹਨ ਇਹ ਜਿਹੜੇ ਕੈਨਵਸ ਦੀ ਜਿਹੜੀ ਪੇਂਟਿੰਗ ਆ ਉਹ ਆਮ ਤੌਰ 'ਤੇ ਤੇਲ ਦੀ ਰੰਗ ਨਾਲ ਕੀਤੀ ਜਾਂਦੀ ਹੈ ਅਤੇ ਸਭ ਤੋਂ ਵਧੀਆ ਵੀ ਮੰਨੀ ਜਾਂਦੀ ਹੈ ਬੱਚੇ ਪਰ ਕਈ ਹੁਣ ਵਾਟਰ ਕਲਰ ਦੀ ਪੇਂਟਿੰਗ ਪਾਣੀ ਦੇ ਜਿਹੜੇ ਪਾਣੀ ਵਾਲੇ ਪੇਂ ਹੁੰਦੇ ਨੇ ਵਾਟਰ ਕਲਰ ਹੋ ਗਏ ਉਹ ਜਿਵੇਂ ਕਿ ਮੋਟਾ ਪੇਪਰ ਜਿਹੜਾ ਹੁੰਦਾ ਉਹਦੇ ਉੱਪਰ ਪੇਂਟ ਕੀਤਾ ਜਾਂਦਾ ਹੈ ਅਤੇ ਉਹ ਡਰੈਂਗ ਸ਼ੀਟ 'ਤੇ ਪੈਂਸਿਲ ਅਤੇ ਮੋਮੀ ਹੈ ਨਾ ਮੋਮ ਵਾਲੇ ਮੋਮ ਵਾਲੇ ਹੁੰਦੇ ਹਨ ਸਕੈਚ ਉਹ ਵੀ ਵਰਤਦੇ ਆ ਸਕੈਚਾਂ ਨੂੰ ਵੀ ਆਪਾਂ ਪੇਪਰ 'ਤੇ ਡਰੈਂਗ ਕਰਦੇ ਆ ਇੱਕ ਫੈਬਰਿਕ ਕਲਰ ਹੁੰਦਾ ਜਿਹੜੇ ਫੈਬਰਿਕ ਕਲਰ ਹੁੰਦਾ ਉਹ ਕੱਪੜਿਆਂ ਦੇ ਉੱਤੇ ਕੀਤੇ ਜਾਂਦੇ ਕੱਪੜਿਆਂ ਦੀ ਪੇਂਟ 'ਤੇ ਕੀਤਾ ਜਾਂਦਾ ਹੈ ਉਹਨਾਂ ਫੈਬਰਿਕ ਜਿਹੜੇ ਹੁੰਦੇ ਨੇ ਉਹ ਕੱਪੜਿਆਂ ਦੇ ਆਪਾਂ ਕੱਪੜਾ ਪੇਂਟ ਕਰਦੇ ਆ ਉਹਨਾਂ 'ਤੇ ਕੀਤਾ ਜਾਂਦਾ ਹੈ ਕੱਚ 'ਤੇ ਵੀ ਪੇਂਟ ਕਈ ਆਪਾਂ ਕੱਚ ਦੇ ਉੱਪਰ ਵੀ ਕਈ ਪੇਂਟ ਕੀਤੇ ਜਾਂਦੇ ਹਨ ਅਲੱਗ ਅਲੱਗ ਕਿਸਮ ਦੇ ਉੱਤੇ ਵੀ ਪੇਂਟਿੰਗ ਕਰ ਸਕਦੇ ਹਾਂ ਆਪਾਂ ਹੈ ਨਾ ਅਤੇ ਕੱਚ ਦੇ ਪੇਂਟ 'ਤੇ ਕਈ ਫਲਾਵਰ ਜਿੱਦਾਂ ਫਲਾਵਰ ਬਣਾ ਲਓ ਪੇਂਟ ਚਾਰਟ ਪੇਪਰ ਵੀ ਹੁੰਦੇ ਨੇ ਇੱਕ ਚਾਟ ਪੇਪਰ ਹੁੰਦੇ ਨੇ ਉਹ ਤਾਂ ਡਰੈਂਗ ਕਰਕੇ ਉੱਪਰ ਕਲਰ ਭਰ ਕੇ ਜਿੱਦਾਂ ਫਲਾਵਰ ਜਿੱਦਾਂ ਪੇਂਟ ਆਪਾਂ ਵਧੀਆ ਬਣਾ ਸਕਦੇ ਹਾਂ ਪੇਂਟ ਉੱਪਰ ਕਰ ਸਕਦੇ ਹਾਂ ਅਤੇ ਇੱਕ ਲੱਕੜ 'ਤੇ ਵੀ ਹਾਂ ਲੱਕੜ 'ਤੇ ਪੇਂਟ ਕਰਨੀ ਹੋਵੇ ਉਹਦੇ ਵੀ ਇੱਕ ਗੱਲ 'ਤੇ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਵਧੀਆ ਪੇਂਟਿੰਗ ਹੋ ਜਾਂਦੀ ਹੈ